ਸਭ ਤੋਂ ਚੁਣੌਤੀ ਪੂਰਨ ਵਿਅੰਜਨ ਹੈ ਸਾਡੀ ਪੜ੍ਹਾਈ ਅਤੇ ਉਸ ਦੇ ਨਾਲ ਜੁੜੇ ਇਮਤਿਹਾਨ ਮੈਂ ਬੀ ਏ ਦੇ ਵਿੱਚ ਫਸਟ ਸੈਮ ਦੇ ਆਪਣੇ ਇਗਜ਼ਾਮ ਦੇਣੇ ਸੀ ਅਤੇ ਉਸਦੇ ਲਈ ਮੇਰੀ ਤਿਆਰੀ ਸੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਘੱਟ ਸੀ ਅਤੇ ਮੇਰੇ ਬਿਮਾਰ ਹੋਣ ਕਰਕੇ ਮੇਰੀ ਇਮਤਿਹਾਨਾਂ ਦੀ ਤਿਆਰੀ ਇੰਨੀ ਜ਼ਿਆਦਾ ਨਹੀ ਹੋ ਸਕੀ ਅਤੇ ਫਿਰ ਜਦੋਂ ਮੇਰੇ ਇਮਤਿਹਾਨ ਨਜ਼ਦੀਕ ਆ ਗਏ ਅਤੇ ਫਿਰ ਮੈਂ ਸੋਚਿਆ ਕਿ ਇਮਤਿਹਾਨਾਂ ਦੇ ਵਿੱਚ ਵਧੀਆ ਨੰਬਰ ਲੈਣ ਦੇ ਲਈ ਵੱਧ ਤੋਂ ਵੱਧ ਪੜ੍ਹਿਆ ਜਾ ਸਕੇ ਪਰ ਮੇਰੇ ਤੋਂ ਜ਼ਿਆਦਾ ਨਹੀ ਪੜ੍ਹਿਆ ਗਿਆ ਸੀ ਪਰ ਇਮਤਿਹਾਨਾਂ ਤੋਂ ਥੋੜ੍ਹੇ ਦਿਨ ਪਹਿਲਾਂ ਮੈਂ ਪੜ੍ਹਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਮੇਰੇ ਲਈ ਇੱਕ ਚੁਣੌਤੀ ਸੀ ਕਿਉਂਕਿ ਮੈਂ ਇਮਤਿਹਾਨ ਵਿੱਚੋ ਪਾਸ ਹੋਣ ਦੇ ਲਈ ਵੱਧ ਤੋਂ ਵੱਧ ਨੰਬਰ ਲੈਣੇ ਸੀ ਅਤੇ ਇਸ ਦੇ ਲਈ ਮੈਂ ਥੋੜ੍ਹੇ ਜੇ ਸਮੇਂ ਦੇ ਵਿੱਚ ਹੀ ਮੈਂ ਬਹੁਤ ਕੁਝ ਸਿੱਖਿਆ ਅਤੇ ਮੈਂ ਪੜ੍ਹੀ ਅਤੇ ਇਹ ਮੇਰਾ ਇੱਕ ਅਜਿਹਾ ਅਨੁਭਵ ਸੀ ਇਸ ਦੇ ਨਾਲ ਮੈਨੂੰ ਪਤਾ ਲੱਗਿਆ ਕਿ ਘੱਟ ਸਮੇਂ ਦੇ ਵਿੱਚ ਕਿੰਨਾਂ ਵੱਧ ਤੋਂ ਵੱਧ ਯਾਦ ਕੀਤਾ ਜਾ ਸਕਦਾ ਏ ਆ ਪੜ੍ਹਾਈ ਨਾਲ ਰਿਲੇਟਡ